ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਮੇਰੀ ਗੱਲ ਗੋਪਾਲ ਸਵੀਟਸ ਦੇ ਨਾਲ ਹੋ ਰਹੀ ਹੈ ਮੈਂ ਤੁਹਾਨੂੰ ਭੋਜਨ ਦਾ ਔਡਰ ਦੇਣਾ ਚਾਹੁੰਦੀ ਹਾਂ ਮੈਂ ਹਰ ਵਾਰ ਤੁਹਾਡੇ ਗੋਪਾਲ ਰੈਸਟੋਰੈਂਟ ਔਰ ਗੋਪਾਲ ਸਵੀਟਸ ਤੋਂ ਹੀ ਅਪਣਾ ਭੋਜਨ ਔਡਰ ਕਰਦੀ ਹਾਂ ਜੋ ਕਿ ਮੈਨੂੰ ਬਹੁਤ ਪਸੰਦ ਹੈ ਅੱਜ ਮੈਂ ਛੋਲੇ ਭਟੂਰੇ ਦਾ ਔਡਰ ਤੁਹਾਡੇ ਨਾਲ ਕਰਨਾ ਚਾਹੁੰਦੀ ਹਾਂ ਮੈਨੂੰ ਛੋਲੇ ਭਟੂਰੇ ਦਾ ਔਡਰ ਸਮੇਂ ਤੋਂ ਪਹਿਲਾਂ ਚਾਹੀਦਾ ਹੈ ਅਗਰ ਜੇਕਰ ਤੁਹਾਡੇ ਕੋਲ ਮਿੱਠੇ ਵਿੱਚ ਆਈਸ ਕਰੀਮ ਜਾਂ ਗੁਲਾਬ ਜਾਮੁਣ ਹੋਣ ਆਈਸ ਕਰੀਮ ਚੋਕਲੇਟ ਫਲੇਵਰ ਦੀ ਚਾਹੀਦੀ ਹੈ ਅਤੇ ਗੁਲਾਬ ਜਾਮੁਣ ਦੇ ਛੇ ਗੁਲਾਬ ਜਾਮੁਣ ਚਾਹੀਦੇ ਹਨ ਗੁਲਾਬ ਜਾਮੁਣ ਗਰਮ ਅਤੇ ਫਰੈਸ਼ ਹੋਣੇ ਚਾਹੀਦੇ ਹਨ ਤਾਂ ਕਿ ਉਸਦਾ ਟੇਸਟ ਅੱਛਾ ਆਏ ਅਤੇ ਮੈਂ ਚਾਹੁੰਦੀ ਹਾਂ ਕਿ ਮੈਨੂੰ ਇਹ ਔਡਰ ਸਮੇਂ ਤੋਂ ਪਹਿਲਾਂ ਮਿਲ ਜਾਵੇ ਕਿਉਂਕਿ ਮੈਂ ਖਾਣੇ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਕਰ ਰਹੀ ਹਾਂ ਚਲੋ ਠੀਕ ਹੈ ਜੀ ਤੁਸੀਂ ਆਪਣੀ ਪੇਮੈਂਟ ਸਕੀਮ ਮੈਨੂੰ ਸਾਂਝਾ ਕਰ ਦਿਓ ਜੇਕਰ ਤੁਹਾਨੂੰ ਔਨਲਾਈਨ ਪੇਮੈਂਟ ਜਾਂ ਕੈਸ਼ ਆਨ ਡਿਲੀਵਰੀ ਦੋਨਾਂ ਵਿੱਚੋਂ ਕਿਸੇ ਦੀ ਵੀ ਕੋਈ ਵੀ ਉਹ ਆਵਸ਼ਕਤਾ ਪੈਂਦੀ ਹੈ ਮੈਂ ਕੈਸ਼ ਆਨ ਡਿਲੀਵਰੀ ਕਰਨ ਲਈ ਵੀ ਤਿਆਰ ਹਾਂ ਅਤੇ ਔਨਲਾਈਨ ਪੇਮੈਂਟ ਕਰਨ ਲਈ ਵੀ ਤਿਆਰ ਹਾਂ ਓਕੇ ਜੀ ਧੰਨਵਾਦ